ਭਾਰਤ ਵਿੱਚ ਸਾਰੇ ਧਰਮਾਂ ਦੇ ਲੋਕ ਏਕਤਾ ਨਾਲ ਰਹਿੰਦੇ ਹਨ ਭਾਰਤ ਵਿੱਚ ਹਰੇਕ ਧਰਮ ਦਾ ਬੰਦਾ ਮਿਲ ਜਾਂਦਾ ਹੈ ਜਿਵੇਂ ਮੁਸਲਮਾਨ ਸਿੱਖ ਹਿੰਦੂ ਇਸਾਈ ਆਦਿ ਇਸ ਕਰਕੇ ਭਾਰਤ ਵਿੱਚ ਬਹੁਤ ਸਾਰੇ ਧਾਰਮਿਕ ਸਥਾਨ ਹਨ ਜਿਵੇਂ ਅਯੋਧਿਆ ਵਿੱਚ ਰਾਮ ਮੰਦਰ ਮਾਤਾ ਵੈਸ਼ਨੂੰ ਦੇਵੀ ਮੰਦਰ ਸ੍ਰੀ ਬਾਲਾ ਜੀ ਧਾਮਸ਼ਾਲਾ ਸਰ ਰਾਜਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਆਦਿ ਅਜਿਹੇ ਹੋਰ ਵੀ ਬਹੁਤ ਸਾਰੇ ਧਾਰਮਿਕ ਸਥਾਨ ਭਾਰਤ ਵਿੱਚ ਹਨ ਰਾਮਨੋਮੀ 'ਤੇ ਅਯੋਧਿਆ ਵਿੱਚ ਭਗਤਾਂ ਦੀਆਂ ਕਤਾਰਾਂ ਲੱਗੀਆਂ ਹੁੰਦੀਆਂ ਹਨ ਇਸ ਤਰ੍ਹਾਂ ਅੰਮ੍ਰਿਤਸਰ ਵਿਖੇ ਵੀ ਸਿੱਖ ਹਿੰਦੂ ਮੁਸਲਮਾਨ ਸਾਰੇ ਧਰਮਾਂ ਦੇ ਲੋਕ ਆਉਂਦੇ ਰਹਿੰਦੇ ਹਨ ਅਤੇ ਉੱਥੇ ਚੌਵੀ ਘੰਟੇ ਲੰਗਰ ਦੀ ਸੇਵਾ ਚੱਲਦੀ ਰਹਿੰਦੀ ਹੈ ਇਸ ਤਰ੍ਹਾਂ ਪਿੰਡਾਂ ਵਿੱਚੋਂ ਬਹੁਤ ਸਾਰੇ ਭਗਤ ਸਾਲਾਸਰਧਾਮ ਲਈ ਜਾਂਦੇ ਹਨ ਪਿੰਡਾਂ ਵਿੱਚੋਂ ਲੋਕ ਬੱਸਾਂ ਲੈ ਕੇ ਜਾਂਦੇ ਹਨ ਅਤੇ ਉੱਥੇ ਸਾਲਾਸਰਧਾਮ ਦਰਸ਼ਨ ਕਰਨ ਲਈ ਜਾਂਦੇ ਹਨ